ਹਾਂ ਸਾਡੇ ਸਕੂਲ ਵਿੱਚ ਲਾਈਬ੍ਰੇਰੀ ਸੀ ਜਿਸ ਵਿੱਚ ਬੈਠ ਕੇ ਮੈਂ ਕਿਤਾਬਾਂ ਪੜ੍ਹਦਾ ਸਾਂ ਬਚਪਨ ਵਿੱਚ ਮੈਂ ਬਾਬੇ ਬੁੱਲੇ ਸ਼ਾਹ ਦੀਆਂ ਵਾਰਾਂ ਅਤੇ ਧਾਰਮਿਕ ਸਾਖੀਆਂ ਦਸ ਦਸਾਂ ਗੁਰੂਆਂ ਬਾਰੇ ਜੋ ਕਿ ਜੀਵਨ ਸਾਖੀਆਂ ਸਨ ਉਹ ਪੜ੍ਹੀਆ ਹਨ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੀਵਨ ਦੀ ਸਿੱਖਿਆ ਬਾਰੇ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਕਿਹੜੇ ਅਸਥਾਨਾਂ 'ਤੇ ਜਾ ਕੇ ਔਰ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਵੱਖ ਵੱਖ ਯਤਨ ਕੀਤੇ ਹਨ ਉਹ ਕਿਤਾਬਾਂ ਪੜ੍ਹ ਕੇ ਮੇਰੇ ਮਨ ਨੂੰ ਬਹੁਤ ਹੀ ਸਕੂਨ ਪਹੁੰਚਦਾ ਸੀ ਔਰ ਹੋਰ ਵੀ ਬਹੁਤ ਸਾਰੇ ਕਵੀਆਂ ਦੀਆਂ ਕਿਤਾਬਾਂ ਅਤੇ ਵਧੀਆ ਵਧੀਆ ਧਰਮ ਦੇ ਬਾਰੇ ਗਿਆਨ ਦਿੱਤਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਬਾਰੇ ਬਹੁਤ ਹੀ ਵਧੀਆ ਕਿਸਮ ਦੀਆਂ ਕਿਤਾਬਾਂ ਮੇਰੇ ਸਕੂਲ ਵਿੱਚ ਸਨ ਔਰ ਮੈਂ ਬਚਪਨ ਵਿੱਚ ਤੋਂ ਹੀ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਹੋਈਆਂ ਕਿਤਾਬਾਂ ਨੂੰ ਪੜ੍ਹਨ ਵਿੱਚ ਮੇਰੀ ਬਹੁਤ ਰੁਚੀ ਹੈ